ਅਸੀਂ ਪਿੰਡ ਪੇਂਡੂ ਖੇਤਰ ਤੋਂ ਬਿਲੋਂਗ ਕਰਦੇ ਹਾਂ ਜਿਵੇਂ ਅਕਸਰ ਪਿੰਡਾਂ ਦੇ ਵਿੱਚ ਪਸ਼ੂ ਰੱਖਦੇ ਹਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਹਨ ਅਤੇ ਪਸ਼ੂ ਪਸ਼ੂਆਂ ਦੀ ਦੇਖਭਾਲ ਪਿੰਡਾਂ ਦੇ ਵਿੱਚ ਬਿਹਤਰ ਢੰਗ ਨਾਲ ਕੀਤੀ ਜਾਂਦੀ ਹੈ ਜਿਵੇਂ ਕਿ ਮੈਂਸ ਸੂਣ ਉਪਰੰਤ ਉਹਦਾ ਕਟਰੂ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਮੈਂਸ ਦੀ ਜੇਰ ਨੂੰ ਕੁੱਤਿਆਂ ਤੋਂ ਬਚਾਉਣ ਲਈ ਉਸ 'ਤੇ ਕੱਪੜਾ ਬੰਨ ਦਿੱਤਾ ਜਾਂਦਾ ਹੈ ਅਤੇ ਉਸਦੀ ਹਰ ਇੱਕ ਢੰਗ ਨਾਲ ਸੇਵਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਉਸਦੇ ਕਟਰੂ ਨੂੰ ਦੁੱਧ ਚੁੰਘਾਇਆ ਜਾਂਦਾ ਹੈ ਅਤੇ ਤੇਲ ਪਿਲਾਇਆ ਜਾਂਦਾ ਹੈ ਹਰ ਮੁੱਢਲੀ ਸਹਾਇਤਾ ਉਸ ਨੂੰ ਦਿੱਤੀ ਜਾਂਦੀ ਹੈ ਅਤੇ ਪਸ਼ੂਆਂ ਦੀ ਗਰਮੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਪਾਣੀ ਪਿਲਾ ਕੇ ਅਤੇ ਨਲਾ ਕੇ ਸੇਵਾ ਕੀਤੀ ਜਾਂਦੀ ਹੈ ਅਤੇ ਦੇਖਭਾਲ ਕੀਤੀ ਜਾਂਦੀ ਹੈ ਪਸ਼ੂ ਪਸ਼ੂਆਂ ਨੂੰ ਹਰ ਇੱਕ ਚਾਰਾ ਵਧੀਆ ਵਧੀਆ ਤਰੀਕੇ ਨਾਲ ਕੁਤਰ ਕੇ ਜਾਂ ਕੱਟ ਕੇ ਖਲਾਇਆ ਜਾਂਦਾ ਹੈ ਅਤੇ ਉਹਨਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਹੈ